ਹੈਲੋ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸਣਾਉ ਕੀ ਕਰੀ ਜਾਂਦੇ ਹੋ ਅੱਜ ਹਾਂਜੀ ਹਾਂਜੀ ਕਿੱਦਾਂ ਦੀ ਜਾਣਕਾਰੀ ਚਾਹੀਦੀ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਉਹ ਦੇਖੋ ਜੀ ਇੱਦਾਂ ਜਿਹੜੀ ਪਿਛਲੀ ਹਿਸਟਰੀ ਹੈ ਨਾ ਉਹ ਤਾਂ ਇਸ ਤਰ੍ਹਾਂ ਹੈ ਕਿ ਵੀ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਉੱਨੀ ਸੌ ਸੰਤਾਲੀ 'ਚ ਹੋਈ ਨਾ ਵੰਡ ਉਦੋਂ ਜਿਹੜੇ ਇਹਨਾਂ ਦੇ ਪਿੰਗਲਵਾੜਾ ਜਿਨ੍ਹਾਂ ਨੇ ਸਟਾਰਟ ਕੀਤਾ ਸੀ ਨਾ ਉਹ ਪੂਰਨ ਸਿੰਘ ਸੀਗੇ ਬੰਦੇ ਜਿਨ੍ਹਾਂ ਨੂੰ ਬਾਅਦ 'ਚ ਪੂਰਨ ਸਿੰਘ ਕਹਿੰਦੇ ਸੀਗੇ ਉਹ ਜਦੋਂ ਸੰਤਾਲੀ ਦੀ ਵੰਡ ਵੇਲੇ ਇੱਥੇ ਆਏ ਨੇ ਇਹਨਾਂ ਦਾ ਕੈਂਪ ਲੱਗਾ ਸੀ ਖਾਲਸਾ ਕੋਲਜ 'ਚ ਉਦੋਂ ਫਿਰ ਬਿਮਾਰੀ ਬਮੂਰੀ ਇੱਥੇ ਕੋਈ ਚੱਲੀ ਸੀ ਅਤੇ ਉਹਦੇ ਕਰਕੇ ਇਹਨਾਂ ਨੂੰ ਨਾ ਬੜਾ ਉੱਥੇ ਸੋਫਟ ਹਾਰਟ ਪਰਸਨ ਸੀਗੇ ਅਤੇ ਇਹ ਫਿਰ ਉੱਥੇ ਚੱਲਦੇ ਰਹੇ ਭਗਤ ਪੂਰਨ ਸਿੰਘ ਜਿਹੜੇ ਸੀਗੇ ਨਾ ਇਹਨਾਂ ਨੇ ਸਾਰੀ ਉਮਰ ਹੀ ਤਕਰੀਬਨ ਜਿਹੜੀ ਹੈ ਆਪਣੀ ਸਮਾਜ ਸੇਵਾ ਦੇ ਵਿੱਚ ਲਾਈ ਸੀ ਅਤੇ ਇਹ ਜਿੰਨੇ ਵੀ ਉਸ ਜ਼ਮਾਨੇ ਦੇ ਵਿੱਚ ਇੱਥੇ ਜਦੋਂ ਤੁਹਨੂੰ ਦੱਸਿਆ ਵੀ ਸੰਤਾਲੀ 'ਚ ਹੋਏ ਬਿਮਾਰ ਬੰਦੇ ਪਿੰਗਲੇ ਹੋਏ ਸੀ ਜਿਹੜੇ ਮਤਲਬ ਬਿਮਾਰ ਸੀ ਕੋਹੜੀ ਸੀ ਵਿਕਲਾਂਗ ਸੀਗੇ ਜਿਹੜੇ ਮਤਲਬ ਕਿ ਮਤਲਬ ਡਫ ਐਂ ਡੰਬ ਜਿਨ੍ਹਾਂ ਨੂੰ ਆਪਾਂ ਬੋਲਦੇ ਮਤਲਬ ਜਿਹੜੇ ਗੂੰਗੇ ਬੋਲੇ ਹੁੰਦੇ ਜਿਨ੍ਹਾਂ ਨੂੰ ਸੁਣ ਸਮਝ ਨਹੀਂ ਸਕਦੇ ਉਹਨਾਂ ਬਾਰੇ ਵੀ ਬਹੁਤ ਜ਼ਿਆਦਾ ਮਤਲਬ ਹਿਰਦਾ ਇਹਨਾਂ ਦਾ ਬੜਾ ਸੌਫਟ ਸੀਗਾ ਅਤੇ ਇਹ ਫਿਰ ਇਹਨਾਂ ਦਾ ਉਹਨਾਂ ਦਾ ਦੁੱਖ ਦਰਦ ਦੇਖ ਨਹੀਂ ਸਕਦੇ ਸੀ ਫਿਰ ਇਹਨਾਂ ਨੇ ਉਹਨਾਂ ਨੂੰ ਇਕੱਠੇ ਕਰਕੇ ਅਤੇ ਇੱਥੇ ਨਾ ਅੰਬਰਸਰ ਬੱਸ ਸਟੈਂਡ ਦੇ ਲਾਗੇ ਇਹਨਾਂ ਨੇ ਉਹ ਖੋਲ੍ਹਿਆ ਸੀਗਾ ਇੱਕ ਜ਼ਮੀਨ ਲਈ ਜ਼ਮੀਨ ਲੈ ਕੇ ਉੱਥੇ ਫੇਰ ਇੱਕ ਛੋਟਾ ਜਿਹਾ ਇਹਨਾਂ ਨੇ ਕਮਰਾ ਲੈ ਕੇ ਅਤੇ ਉੱਥੇ ਸੋਸਾਇਟੀ ਸ਼ੁਰੂ ਕੀਤੀ ਜਿਹਦਾ ਨਾਮ ਇਹਨਾਂ ਨੇ ਪਿੰਗਲਵਾੜਾ ਰੱਖਿਆ ਕਿਉਂਕਿ ਇਹਨਾਂ ਦੇ ਕੋਲ ਬਲਕਿ ਬਹੁਤ ਸਾਰੇ ਉਦੋਂ ਸੰਤਾਲੀ ਵੇਲੇ ਜਦੋਂ ਲੋਕ ਸੀਗੇ ਜਿਨ੍ਹਾਂ ਦੇ ਘਰ ਘਰ ਖਰਾਬ ਹੋ ਗਏ ਅਤੇ ਹੋ ਗਏ ਅਤੇ ਕੁਛ ਦੇ ਜਿਹੜੇ ਕੋਹੜ ਦੇ ਰੋਗੀ ਸੀਗੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਇਹਨਾਂ ਨੇ ਫਿਰ ਲਿਆ ਕੇ ਇੱਥੇ ਰੱਖੇ ਅਤੇ ਸਾਰੀ ਉਮਰ ਹੀ ਇਹਨਾਂ ਨੇ ਮਤਲਬ ਕਿ ਸਮਾਜ ਸੇਵਾ ਦਾ ਕੰਮ ਕੀਤਾ ਅਤੇ ਦਰਬਾਰ ਸਾਹਿਬ ਦੇ ਕੋਲ ਉਹਦੇ ਗੇਟ 'ਤੇ ਹੀ ਬੈਠੇ ਹੁੰਦੇ ਸੀਗੇ ਸਾਰੀ ਉਮਰ ਉੱਥੇ ਬੈਠੇ ਰਹੇ ਨੇ ਆਪਣੇ ਨਾਲ ਉਹਨਾਂ ਦੇ ਇੱਕ ਹੁੰਦਾ ਸੀਗਾ ਸਿੱਖ ਇਹਨਾਂ ਦੇ ਨਾਲ ਪਿਆਰਾ ਸਿੰਘ ਉਹਦੇ ਨਾਲ ਸੇਵਾ ਇਹਨਾਂ ਨੇ ਬਹੁਤ ਕੀਤੀ ਸਾਰੀ ਉਮਰ ਉਹਨੂੰ ਆਪਣੇ ਕੋਲ ਰੱਖਿਆ ਫਿਰ ਇਸ ਤਰ੍ਹਾਂ ਇਹਨਾਂ ਨੇ ਕਾਫੀ ਸੰਸਥਾ ਬਣਾਈ ਇੱਥੇ ਹੌਲੀ ਹੌਲੀ ਚੱਲਦਾ ਰਿਹਾ ਹੁਣ ਇਹ ਬਸ ਇਹਨਾਂ ਦਾ ਕੰਮ ਕਰਦੀ ਹੈ ਪਹਿਲਾਂ ਕਿਸੇ ਵੇਲੇ ਹਿੰਦੁਸਤਾਨ ਪਦਮ ਸ਼੍ਰੀ ਦਿੱਤਾ ਸੀ ਪਹਿਲਾਂ ਇਹਨਾਂ ਨੂੰ ਅਤੇ ਜਦੋਂ ਚੁਰਾਸੀ 'ਚ ਅਟੈਕ ਹੋਇਆ ਫਿਰ ਉਦੋਂ ਇਹਨਾਂ ਨੇ ਆਪਣਾ ਪਦਮ ਸ਼੍ਰੀ ਜਿਹੜਾ ਹੈ ਰੋਸ ਵਜੋਂ ਗੋਰਮਟ ਨੂੰ ਵਾਪਸ ਕਰਤਾ ਸੀਗਾ ਹੋਰ ਵੀ ਇਹਨਾਂ ਨੂੰ ਬੜੇ ਨੋਵਲ ਸ਼ਾਂਤੀ ਦੇ ਪੁਰਸਕਾਰ ਵਗੈਰਾ ਬਹੁਤ ਇਹਨਾਂ ਨੂੰ ਮਿਲੇ ਸੀਗੇ ਅਤੇ ਹੁਣ ਵੀ ਮਤਲਬ ਹਿੰਦੁਸਤਾਨ ਦੇ ਵਿੱਚ ਇਸ ਤੋਂ ਵੱਡੀ ਸੰਸਥਾ ਜਿਹੜੀ ਹੈ ਹੋਰ ਨਹੀਂ ਹੈਗੀ ਜਿਹੜੀ ਇਹਨਾਂ ਨੂੰ ਮਤਲਬ ਜਿਹੜੇ ਉਹ ਹੈਗੇ ਨੇ ਪਿੰਗਲਵਾੜੇ ਦੇ ਵਿੱਚ ਲੋਕ ਜਿਨ੍ਹਾਂ ਨੂੰ ਜਿਹੜੇ ਸਾਂਭਦੇ ਨੇਗੇ ਪਿੰਗਲੇ ਲੋਕ ਹੋ ਗਏ ਜਾਂ ਜਿਨ੍ਹਾਂ ਨੂੰ ਕੋਹੜ ਦੇ ਰੋਗ ਨੇ ਜਾਂ ਹੋਰ ਜਿਹੜੇ ਯਤੀਮ ਬੱਚੇ ਨੇ ਇਸ ਤਰ੍ਹਾਂ ਦੇ ਜਿਹੜੇ ਗੂੰਗੇ ਬੋਲੇ ਨੇ ਬੱਚੇ ਨੇ ਇਸ ਤਰ੍ਹਾਂ ਦੇ ਸਾਰੇ ਬਹੁਤ ਸਾਰੇ ਬੱਚੇ ਅੱਜ ਵੀ ਇਹਨਾਂ ਦੇ ਇੱਥੇ ਪਿੰਗਲਵਾੜੇ ਹੈਗੇ ਨੇ ਬਾਕੀ ਪਬਲਿਕ ਦੀ ਏਡ ਨਾਲ ਇਹਦਾ ਚੱਲਦਾ ਪਿਆ ਕੰਮ ਸਕੂਲ ਵੀ ਇਹਨਾਂ ਦੇ ਹੈਗੇ ਕਾਲਜ ਵੀ ਖੋਲ੍ਹ ਲਏ ਬਥੇਰਾ ਕੁਛ ਇਹਨਾਂ ਦਾ ਹੈਗਾ ਇੱਥੇ ਅੰਬਰਸਰ 'ਚ ਹੀ ਇੱਥੇ ਮਾਨਾਂ ਆਲੇ ਕੋਲ ਇਹਨਾਂ ਦਾ ਸਕੂਲ ਆ ਬਹੁਤ ਵੱਡਾ ਬਾਕੀ ਹੋਰ ਵੀ ਪੰਜਾਬ ਦੇ ਵਿੱਚ ਹਾਂ ਬਹੁਤ ਵੱਡੀ ਔਰਗਨਾਈਜੇਸ਼ਨ ਹੁਣ ਤਾਂ ਬਣ ਗਈ ਹੈਗੀ ਹੈ ਅਤੇ ਬੜਾ ਉੱਥੇ ਉਹਨਾਂ ਦੇ ਆਪਣਾ ਇਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ ਸਾਰੀ ਜ਼ਿੰਦਗੀ ਇਹਨਾਂ ਨੇ ਇੱਕ ਗੋਦ ਲਈ ਸੀ ਬੇਟੀ ਸਪਨਾ ਬੀਬੀ ਇੰਦਰਜੀਤ ਕੌਰ ਉਹਨਾਂ ਦਾ ਨਾਂ ਸੰਗਰੂਰ ਤੋਂ ਸੀਗੇ ਰਿਲੇਟਿਡ ਉਹ ਚੇਅਰਪਰਸਨ ਨੇ ਇਸ ਵੇਲੇ ਦੇ ਪਿੰਗਲਵਾੜੇ ਦੇ ਉਹ ਹੀ ਇਹਦੀ ਦੇਖ ਰੇਖ ਕਰਦੇ ਨੇ ਬਹੁਤ ਵੱਡਾ ਇਹਨਾਂ ਦਾ ਸਮਾਜ 'ਚ ਯੋਗਦਾਨ ਹੈ ਪਿੰਗਲਵਾੜੇ ਦਾ ਹਾਂਜੀ ਠੀਕ ਹੈ ਹਾਂਜੀ ਬਹੁਤ ਗਰੇਟ ਪਰਸਨੈਲਟੀ ਸੀ ਉਹਨਾਂ ਦੀ

ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਓਕੇ ਜੀ ਓਕੇ ਓਕੇ ਜੀ ਓਕੇ